ਹੈਲੋ ਵਧੀਆ ਵਧੀਆ ਅਰਸ਼ ਤੂੰ ਸੁਣਾ ਅੱਜ ਕੱਲ੍ਹ ਤਾਂ ਕੁਛ ਨਹੀਂ ਜੋਬ ਵਗੈਰਾ ਹੀ ਲੱਭ ਰਹੀ ਹਾਂ ਜਾਂ ਤਾਂ ਮੈਂ ਸੋਚਿਆ ਕਿ ਜੋਬ ਕੀ ਕਰਨੀ ਆ ਅੱਜ ਦੇ ਟਾਈਮ ਵਿੱਚ ਕੋਈ ਨਾ ਕੋਈ ਸਟਾਰਟਅੱਪ ਕਿਉਂ ਨਾ ਸ਼ੁਰੂ ਕੀਤਾ ਜਾਵੇ ਹਾਂ ਕਿਉਂ ਨਾ ਇਕੱਠੇ ਸ਼ੁਰੂ ਕਰੀਏ ਆਪਾਂ ਹਾਂ ਅੱਜ ਕੱਲ੍ਹ ਤਾਂ ਬਹੁਤ ਸਾਰੇ ਲੋਕ ਬੜਾ ਕੁਛ ਕਰ ਰਹੇ ਆ ਉਤੋਂ ਕੁਛ ਯੁਨੀਕ ਹੀ ਕਰਨਾ ਪੈਣਾ ਆਪਾਂ ਨੂੰ ਤਾਂ ਹਾਂ ਯਾਰ ਟਿਊਸ਼ਨ ਸੈਂਟਰ ਵਧੀਆ ਆਈਡੀਆ ਵਾ ਅੱਜ ਕੱਲ੍ਹ ਤਾਂ ਮੈਥ ਸਾਇੰਸ ਦੇ ਟੀਚਰਜ ਲੱਭਦੇ ਵੀ ਨਹੀਂ ਆ ਹਾਂ ਆਪਾਂ ਨੂੰ ਫਿਰ ਕਰਨਾ ਹੀ ਪੈਣਾ ਮੈਨੂੰ ਲੱਗਦਾ ਕੋਈ ਲੋਕੇਸ਼ਨ ਵਗੈਰਾ ਲੱਭ ਕੇ ਤਾਂ ਆਪਾਂ ਉੱਥੇ ਬਣਾਉਂਦੇ ਹਾਂ ਆਪਣਾ ਸੈਂਟਰ ਬਾਕੀ ਜੋ ਵੀ ਪੈਂਪਲੇਟਸ ਆ ਜਾਂ ਓਹ ਆਪਾਂ ਉਹਨੂੰ ਔਨਲਾਈਨ ਜ਼ਿਆਦਾ ਕਰਕੇ ਪ੍ਰਮੋਟ ਕਰ ਦਾਂਗੇ ਹਾਂ ਚਲ ਬਾਕੀ ਆਪਣੀ ਨੇਬਰ ਵਗੈਰਾ 'ਚ ਅਤੇ ਰੈਲੇਟਿਵਸ 'ਚ ਵੀ ਦੱਸ ਦੀਏ ਆਪਾਂ ਇੱਕ ਸੈਂਟਰ ਖੋਲ੍ਹ ਰਹੇ ਹਾਂ ਹਾਂ ਚੱਲ ਓਕੇ ਠੀਕ ਆ ਜਲਦੀ ਕਰਦੇ ਹਾਂ ਸਾਰਾ ਕੁਛ ਹਾਂ ਚਲ ਓਕੇ